ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਅ ਜੀ ਮੈਂ ਦਾ ਭਾਈ ਬੋਲਦਾ ਜੀ ਹਾਂਜੀ ਹਾਂਜੀ ਹਾਂਜੀ ਕਪੂਰਥਲਾ ਰਹਿੰਦੇ ਜੀ ਆਪਾਂ ਹਾਂਜੀ ਭਾਅ ਜੀ ਸ਼ਾਇਦ ਮਿਲੇ ਆ ਅਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਜੀ ਹਾਂਜੀ ਭਾਅ ਜੀ ਆਪਣਾ ਆਪ ਦਾ ਕੰਮ ਹੈਗਾ ਸਲੂਨ ਦਾ ਹਾਂਜੀ ਸਾਡਾ ਦਸ ਬਾਰਾਂ ਸਾਲ ਦਾ ਐਕਸਪੀਰੀਅਸ ਹੈਗਾ ਇਹ ਤੇ ਤੁਹਾਡੇ ਕਿਉਂਕਿ ਮੈਨੂੰ ਦੱਸ ਸਕਦੇ ਤੁਹਾਡੇ ਇਹ ਹੇਅਰ ਤੇ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਕੀ ਦਿੱਕਤ ਤਾਂ ਆ ਰਹੀ ਜਿਹਦੇ ਕਰਕੇ ਤੁਸੀਂ ਪੁੱਛ ਰਹੇ ਹੋ ਹਾਂਜੀ ਜੀ ਹਾਂਜੀ ਹਾਂਜੀ ਠੀਕ ਐ ਠੀਕ ਐ ਜੀ ਨਹੀਂ ਨਹੀਂ ਨਹੀਂ ਭਾਅ ਜੀ ਭਾਅ ਜੀ ਦੇਖੋ ਤੁਸੀਂ ਇੱਕ ਪਹਿਲਾਂ ਪਹਿਲਾਂ ਸਿਰਮ ਦੱਸੋ ਕਿਹੜੇ ਪ੍ਰੋਡਕਟ ਦਾ ਵਰਤਦੇ ਹੋ ਤੇ ਇੱਕ ਆਪਣਾ ਹੇਅਰ ਆਇਲ ਦੱਸੋ ਕਿਹੜਾ ਵਰਤਦੇ ਤੇ ਇੱਕ ਆਪਣਾ ਸ਼ੈਪੂ ਦੱਸੋ ਕੰਡੀਸ਼ਨਲ ਦੱਸੋ ਕਿਹੜਾ ਵਰਤਦੇ ਹੋ ਭਾਜੀ ਮੈਂ ਤੁਹਾਨੂੰ ਥੋੜਾ ਹੇਅਰ ਫੋਲ ਕਹਿੰਦਾ ਮੈਂ ਤੁਹਾਨੂੰ ਪ੍ਰੋਡਕਟ ਦੱਸਦਾ ਏ ਤੁਸੀਂ ਪਹਿਲਾਂ ਇਹੀ ਯੂਜ ਕਰਕੇ ਦੇਖਿਓ ਜੇ ਤਾਂ ਇਹਦੇ ਨਾਲ ਤੁਹਾਡਾ ਸਹੀ ਚਲਦਾ ਤਾਂ ਠੀਕ ਹੈ ਨਹੀਂ ਫਿਰ ਟਰੀਟਮੈਂਟ ਕਰਦਾਂਗੇ ਆਪਣੇ ਕੋਲ ਟਰੀਟਮੈਂਟ ਵੀ ਹੈ ਸਾਰਾ ਜਿੱਦਾ ਦਾ ਹੇਅਰਫੋਲ ਜਿੱਦਾਂ ਹੁੰਦੇ ਕਈ ਪ੍ਰੋਡਕਟ ਜਿਆਦਾ ਕੈਮੀਕਲ ਹੋਣ ਕਰਕੇ ਸਾਡੇ ਹੇਅਰਫੋਲ ਹੋਣ ਲੱਗ ਪੈਂਦਾ ਏ ਜਾ ਅਸੀਂ ਕਈ ਵਾਰੀ ਹੇਅਰ ਦੀ ਕੇਅਰ ਨਹੀਂ ਕਰਦੇ ਜਿਆਦਾ ਡਰਾਇਅਰ ਫੇਰਦੇ ਆ ਉਹਦੇ ਨਾਲ ਹੋਣ ਲੱਗ ਪੈਂਦਾ ਧੂੜ ਮਿੱਟੀ ਚ ਜਿਆਦਾ ਰਹਿੰਦੇ ਆ ਉਹਦੇ ਨਾਲ ਹੇਅਰਫੋਲ ਹੋਣ ਲੱਗ ਪੈਂਦਾ ਜਿਦਾਂ ਆਪਾਂ ਨੇ ਇੱਕ ਤਾਂ ਕੋਟਨ ਵਾਲਾ ਪਿਲੋ ਨੀ ਵਰਤਣਾ ਭਾਜੀ ਉਹ ਥੋੜਾ ਜਿਹਾ ਉਹ ਹੋਣਾ ਚਾਹੀਦਾ ਕੋਟਨ ਵਾਲਾ ਨਹੀਂ ਹੋਣਾ ਚਾਹੀਦਾ ਉਸ ਨਾਲ ਵੀ ਆਪਣੇ ਵਾਲ ਡਰਾਈ ਡਰਾਈ ਜਿਹੇ ਰਹਿਦੇ ਟੁੱਟਣ ਦਾ ਡਰ ਰਹਿੰਦਾ ਤੇ ਭਾਅ ਜੀ ਜਿੱਦਾਂ ਤੁਸੀਂ ਹੁਣ ਹਫਤੇ ਤੁਸੀਂ ਤਿੰਨ ਵਾਰੀ ਤਾਂ ਆਇਲਿੰਗ ਕਰਵਾਉਣੀ ਹੈ ਸਿਰ ਤੇ ਚੰਗੀ ਤਰ੍ਹਾਂ ਇੱਕ ਇੱਕ ਦਿਨ ਛੱਡ ਕੇ ਤੇ ਤੁਸੀਂ ਹਫਤੇ ਚ ਤਿੰਨ ਦਿਨ ਸ਼ੈਪੂ ਕਰਨਾ ਤੇ ਇੱਕ ਦਿਨ ਤੁਸੀਂ ਵਧੀਆ ਤਰੀਕੇ ਨਾਲ ਸਿਰਮ ਸੁਰਮ ਵਰਤ ਕੇ ਵਧੀਆ ਪ੍ਰੋਡਕਟ ਦਾ ਵਰਤ ਕੇ ਉਸ ਨਾਲ ਤੁਹਾਡੇ ਫਿਰ ਬਹੁਤ ਇਫੈਕਟ ਪੈ ਜਾਏਗਾ ਵਾਲਾਂ ਨੂੰ ਹਾਂਜੀ ਹਾਂਜੀ ਹਾਂਜੀ ਥੋਡੇ ਭਾਅ ਜੀ ਬਾਲ ਹਲਕੇ ਕਿ ਭਾਰੀ ਹੈ ਠੀਕ ਹੈ ਭਾਅ ਜੀ ਠੀਕ ਆ ਤੁਹਾਨੂੰ ਜਿਹੜੀ ਚੀਜ਼ਾਂ ਦੱਸੀਆਂ ਨਾ ਉਹ ਕਰੋ ਭਾਅ ਜੀ ਉਹਦੇ ਨਾਲ ਫਰਕ ਪੈ ਸਕਦੇ ਏ ਜੇ ਨਹੀਂ ਪੈ ਤੁਸੀਂ ਸਾਡੇ ਕੋਲ ਆਜਿਓ ਇਕ ਵਾਰੀ ਅਸੀਂ ਤੁਹਾਨੂੰ ਦੇਖ ਲਾਂਗੇ ਵੀ ਕੀ ਪ੍ਰੋਬਲਮ ਆ ਕਈ ਵਾਰੀ ਡੈਂਡਰਫ ਵਗੈਰਾ ਕਰਕੇ ਇੱਕ ਤਾਂ ਆਪਾਂ ਵੋਮ ਵਾਟਰ ਨੀ ਵਰਤਣਾ ਜਿਹੜੀ ਨੋਰਮਲ ਵਾਟਰ ਵੀ ਨਹੀਂ ਵਰਤਣਾ ਕਾਲਡ ਵਾਟਰ ਨਾਲ ਸਿਰ ਧੋਵੋ ਹਾਂਜੀ ਭਾਅ ਜੀ ਭਾਅ ਜੀ ਹੁਣ ਥੋਨੂੰ ਦੇਖਣਾ ਤਾਂ ਪੈਣਾ ਜੀ ਹਾਂਜੀ ਹਾਂਜੀ ਇਕੱਲਾ ਸਿਰ ਧੋ ਲਓ ਜੀ ਭਾਅ ਜੀ ਨਲਕੇ ਆਲਾ ਐਂ ਤਾਂ ਤੁਸੀਂ ਨਹਿਰ ਚ ਵੀ ਦੇ ਸਕਦੇ ਜੀ ਉਹ ਚ ਦੇ ਕੇ ਤੁਸੀਂ ਚਾਹੇ ਨਾਹ ਲਓ ਉਹ ਕੋਈ ਚੱਕਰ ਨਹੀਂ ਹੈਗਾ ਜੀ ਹਾਂਜੀ ਹਾਂਜੀ ਹਾਂਜੀ ਹੋਰ ਕੋਈ ਦਿੱਕਤ ਤਾਂ ਨੀ ਆ ਰਹੀ ਵਾਲਾਂ ਨੂੰ ਚਲੋ ਠੀਕ ਹੈ ਠੀਕ ਹੈ ਓਕੇ ਜੀ ਓਕੇ